ਆ ਹਾਂ ਮੈਂ ਉੱਚੀਆਂ ਥਾਵਾਂ ਤੋਂ ਜਾਂ ਉੱਚਾਈ ਵਾਲੀਆਂ ਜਿਹੜੀਆਂ ਇਮਾਰਤਾਂ ਨੇਗੀਆਂ ਚੀਜ਼ਾਂ ਨੇ ਉਹਨਾਂ ਤੋਂ ਕਾਫੀ ਜ਼ਿਆਦਾ ਜਿਹੜਾ ਡਰਦੀ ਸੀਗੀ ਮੇਰੇ ਬਚਪਨ ਦੇ ਵਿੱਚ ਇਹ ਡਰ ਕਾਫੀ ਮੇਰੇ 'ਤੇ ਹਾਵੀ ਸੀਗਾ ਫਿਰ ਹੌਲੀ ਹੌਲੀ ਵਕਤ ਦੇ ਨਾਲ ਇਹ ਚੀਜ਼ਾਂ ਨੇ ਜਿਹੜੀਆਂ ਉਹ ਘੱਟਦੀਆਂ ਗਈਆਂ ਇਸ ਚੀਜ਼ 'ਚੋਂ ਨਿਕਲਣ ਦੇ ਲਈ ਮੇਰੇ ਪੇਰੈਂਟਸ ਮੇਰੇ ਮਾਤਾ ਪਿਤਾ ਮੇਰੇ ਸਿਬਲਿੰਗ ਮੇਰੇ ਭਰਾ ਮੇਰੇ ਭੈਣ ਉਹਨਾਂ ਦਾ ਕਾਫੀ ਜ਼ਿਆਦਾ ਯੋਗਦਾਨ ਰਿਹਾ ਹੌਲੀ ਹੌਲੀ ਮੈਂ ਖੁਦ ਨੂੰ ਮਾਨਸਿਕ ਤੌਰ 'ਤੇ ਸਰਟਰੋਂਗ ਬਣਾਇਆ ਕਿ ਮੈਂ ਇਹਨਾਂ ਚੀਜ਼ਾਂ 'ਚੋਂ ਨਿਕਲ ਸਕਦੀ ਹਾਂ ਅਤੇ ਇਹ ਬਹੁਤ ਹੀ ਜਿਹੜੇ ਛੋਟੇ ਜਿਹੇ ਡਰ ਹੈਗਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਇਹਦੇ ਲਈ ਮੇਰੇ ਘਰਦਿਆਂ ਨੇ ਮੈਨੂੰ ਹੌਲੀ ਹੌਲੀ ਉੱਚੀਆਂ ਥਾਵਾਂ 'ਤੇ ਲਿਜਾਣਾ ਸ਼ੁਰੂ ਕੀਤਾ ਉੱਚੀਆਂ ਬਿਲਡਿੰਗਾਂ 'ਤੇ ਤਾਂ ਕਿ ਮੇਰੇ ਅੰਦਰੋਂ ਜਿਹੜਾ ਡਰ ਹੈ ਉਹ ਨਿਕਲ ਸਕੇ ਇਸ ਤੋਂ ਇਲਾਵਾ ਮੈਨੂੰ ਉਹਨਾਂ ਨੇ ਹਿਲ ਸਟੇਸ਼ਨ ਲੈ ਕੇ ਜਾਣਾ ਸ਼ੁਰੂ ਕੀਤਾ ਕਿਉਂਕਿ ਪਹਾੜ ਤੁਹਾਡੇ ਅੰਦਰੋਂ ਉੱਚਾਈ ਦਾ ਡਰ ਕੱਢਣ ਲਈ ਸਭ ਤੋਂ ਜ਼ਿਆਦਾ ਜਿਹੜੀ ਕੁਦਰਤੀ ਵਾਤਾਵਰਣ ਹੈ ਉਹ ਬਣਾਉਂਦੇ ਨੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੇ ਮੇਰੀ ਸਹਾਇਤਾ ਕੀਤੀ ਅਤੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਆਪਣੀ ਉੱਚਾਈ ਦੇ ਡਰ ਨੂੰ ਕਾਬੂ ਕਰ ਸਕੀ